ਮੇਰੇ ਵਿਚਾਰਾਂ ਅਨੁਸਾਰ ਇੱਕੀਵੀਂ ਸਦੀ ਟੈਕਨੋਲੋਜੀ ਦੇ ਤੋਹਫੇ ਜਿਵੇਂ ਕਿ ਇੰਟਰਨੈਟ ਸਮਾਰਟ ਫੋਨ ਸੁਪਰ ਫਾਸਟ ਕੰਪਿਊਟਰ ਵਗੈਰਾ ਆਦਿ ਸਮਾਰਟ ਟੀਵੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੋ ਕਿ ਮੇਲ ਮਿਲਾਪ ਸਾਡੇ ਜੀਵਨ ਦਾ ਬਣਿਆ ਹੋਇਆ ਹੈ ਟੈਕਨੋਲਜੀ ਸਾਡੀ ਰੋਜ਼ਾਨਾ ਰੂਟੀਨ ਦਾ ਇੱਕ ਹਿੱਸਾ ਅਤੇ ਪਾਰਸਲ ਬਣ ਗਈ ਹੈ ਅਤੇ ਇਸਨੇ ਸਾਡੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਸਾਡੇ ਰੋਜ਼ਾਨਾ ਜੀਵਨ ਦੇ ਲਗਭਗ ਸਾਰੇ ਖੇਤਰਾਂ ਵਿੱਚ ਟੈਕਨੋਲੋਜੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਜਿਸ ਤੋਂ ਬਿਨਾਂ ਆਧੁਨਿਕ ਸੱਭਿਅਤਾ ਦੀ

ਮਸ਼ੀਨਰੀ ਬਚਣਾ ਬੰਦ ਕਰ ਦੇਵੇਗੀ ਮਸ਼ੀਨਰੀ ਇੱਕ ਬਹੁਤ ਅਹਿਮ ਜ਼ਰੂਰਤ ਬਣ ਗਈ ਹੈ ਸਾਡੇ ਜੀਵਨ ਵਿੱਚ ਅਤੇ ਸਾਡੇ ਭਾਰਤ ਦੀਆਂ ਕਈ ਮਸ਼ੀਨਾਂ ਅਤੇ ਕਈ ਅਜਿਹੀਆਂ ਟੈਕਨੋਲੋਜੀਕਲ

ਬਾਹਰਲੇ ਮੁਲਕਾਂ ਵਿੱਚ ਵੀ ਜਾ ਰਹੀਆਂ ਹਨ ਅਤੇ ਉਹਨਾਂ ਦੀਆਂ ਕਈ ਅਜਿਹੀਆਂ ਟੈਕਨੋਲੋਜੀ ਚੀਜ਼ਾਂ ਅਸੀਂ ਵੀ ਉਪਯੋਗ ਕਰਨ ਲੱਗ ਗਏ ਹਾਂ ਅੱਜ ਦੀ ਦੁਨੀਆਂ ਟੈਕਨੋਲਜੀ 'ਤੇ ਇੰਨੀ ਜ਼ਿਆਦਾ ਨਿਰਭਰ ਹੈ ਕਿ ਇਸ ਦੇ ਨਾਲ ਤੋਂ ਇਸਦੇ ਜਾਣ ਤੋਂ ਬਾਹਰ ਆਉਣਾ ਬਹੁਤ ਅਸੰਭਵ ਹੋ ਚੁੱਕਿਆ ਹੈ